ਜਿਸ ਤਰ੍ਹਾਂ ਆਪਾਂ ਦੇਖ ਸਕਦੇ ਹੈਗੇ ਹੈ ਬਈ ਜਿੱਦਾਂ ਜਿਹੜੀ ਬਿਜਲੀ ਹੈਗੀ ਹੈ ਉਹ ਸਾਡੇ ਭਾਵੇਂ ਛੋਟੇ ਤੋਂ ਛੋਟੇ ਕੰਮ ਹੋਵੇ ਭਾਵੇਂ ਬੜੇ ਤੋਂ ਬੜਾ ਕੰਮ ਹੋਵੇ ਸਾਰਿਆਂ ਵਿੱਚ ਸਾਨੂੰ ਬਿਜਲੀ ਦੀ ਲੋੜ ਪੈਂਦੀ ਹੈਗੀ ਹੈ ਹੁਣ ਜਿਹੜੀ ਬਿਜਲੀ ਹੈਗੀ ਹੈ ਸਾਡੀ ਰੋਜ਼ੀ ਰੋਟੀ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕਰਦੀ ਹੈਗੀ ਹੈ ਜਿੱਦਾਂ ਹੁਣ ਆਪਾਂ ਘਰਾਂ ਤੇ ਜਿਹੜੇ ਬਿਜਲੀ ਵਾਲੇ ਚੁੱਲ੍ਹੇ ਹੈਗੇ ਉਹਨਾਂ 'ਤੇ ਫੁੱਲਕੇ ਬਣਾਉਣ ਲੱਗ ਪੈਂਦੇ ਹੈਗੇ ਹੈ ਇਹ ਤੋਂ ਇਲਾਵਾ ਜਿੱਦਾਂ ਹੁਣ ਮੰਨ ਲਉ ਬਿਜਲੀ ਦੇ ਕੱਟ ਵਗੈਰਾ ਲੱਗਦੇ ਹੈਗੇ ਜਦੋਂ ਓਦੋਂ ਸਾਨੂੰ ਪਰੇਸ਼ਾਨੀਆਂ ਦਾ ਸਾਹਮਣਾ ਤਾਂ ਕਰਨਾ ਪੈਂਦਾ ਹੈਗਾ ਏ ਬਈ ਤਾਂ ਇਹਦੇ ਕਰਕੇ ਜਿਹੜੇ ਲੋਕਾਂ ਨੇ ਹੈਗਾ ਇੱਥੇ ਇਨਵਰਟਰ ਵੀ ਰੱਖੇ ਹੈਗੇ ਹੈ ਜਿੱਦਾਂ ਹੁਣ ਇਨਵਰਟਰ ਹੁੰਦਾ ਹੈਗਾ ਕਿਸੇ ਦੀ ਲਾਇਟ ਚੱਲ ਗਈ ਅਗਲੇ ਨੇ ਇਨਵਰਟਰ ਚਾਲੂ ਕਰ ਲਿਆ ਅਗਲੇ ਦੇ ਪੂਰੇ ਘਰ 'ਚ ਜੋ ਵੀ ਜਿੱਥੇ ਜਿੱਥੇ ਅਗਲੇ ਨੇ ਜ਼ਰੂਰੀ ਚੀਜ਼ਾਂ ਹੈਗੀਆਂ ਉਹਨਾਂ ਨੂੰ ਕਨੈਕਸ਼ਨ ਦਿੱਤੇ ਹੁੰਦੇ ਹੈ ਉਹ ਸਾਰੀਆਂ ਚੀਜ਼ਾਂ ਚੱਲਣੀਆਂ ਸ਼ੁਰੂ ਹੋ ਜਾਂਦੀਆਂ ਹੈਗੀਆਂ ਏ ਜੇ ਕਿਸੇ ਨੇ ਇਨਵਰਟਰ ਨਹੀਂ ਰੱਖਿਆ ਹੈਗਾ ਏ ਤਾਂ ਦੋ ਚਾਰ ਘਰਾਂ ਨੇ ਰਲ਼ ਕੇ ਜਨਰੇਟਰ ਵਗੈਰਾ ਲਿਆ ਹੋਇਆ ਹੈਗਾ ਏ ਜਨਰੇਟਰ ਨਾਲ ਕਿਆ ਹੈਗਾ ਦੋ ਚਾਰ ਘਰਾਂ ਦੇ ਪੂਰੀ ਐਨ ਵਧੀਆ ਢੰਗ ਨਾਲ ਲਾਇਟ ਚੱਲਦੀ ਹੈਗੀ ਹੈ ਉਹਦੇ ਨਾਲ ਪੂਰੇ ਘਰ ਵਧੀਆ ਐਨ ਆਰਾਮ ਨਾਲ ਪੂਰੀ ਰਾਤ ਵੀ ਕੱਢ ਲੈਂਦੇ ਰੋਟੀ ਪਾਣੀ ਵੀ ਜੋ ਵੀ ਬਣਾਉਣਾ ਹੁੰਦਾ ਅਗਲੇ ਨੇ ਬਿਜਲੀ ਦੀਆਂ ਸਾਰਾ ਕੰਮ ਕਰਦੇ ਹੈਗੇ ਹੈ ਇਹ ਤੋਂ ਇਲਾਵਾ ਲੋਕਾਂ ਨੇ ਇੱਥੇ ਜਿਹੜੇ ਹੈਗੇ ਹੈ ਉਹਨਾਂ ਨੇ ਜਿਹੜੇ ਸੋਲਰ ਜਿਹੜੀਆਂ ਪਲੇਟਾਂ ਹੁੰਦੀਆਂ ਹੈਗੀਆਂ ਏ ਸੂਰ ਦੀ ਜਿਹੜੀਆਂ ਹੁੰਦੀਆਂ ਪਲੇਟਾਂ ਉਹ ਵੀ ਲਾਈਆਂ ਵੀ ਹੈਗੀਆਂ ਏ ਉਹ ਬਿਜਲੀ ਲਵਾ ਉਹਨਾਂ ਬਿਜਲੀ ਦੇ ਕਨੈਕਸ਼ਨ ਏ ਲਏ ਵੇ ਹੈਗੇ ਹੈ ਉਹ ਵੀ ਸੋਲਰ ਪਲੇਟਾਂ ਲਵਾ ਕੇ ਅਗਲਿਆਂ ਨੇ ਆਪਣੇ ਆਪਣੇ ਘਰਾਂ ਨੂੰ ਬਿਜਲੀ ਵੀ ਨਾਲੇ ਆਪ ਆਪ ਵੀ ਯੂਜ਼ ਕਰਦੇ ਹੈਗੇ ਉਹਨੂੰ ਅਗਲੇ ਨੂੰ ਬਿਜਲੀ ਦੇ ਕੱਟ ਨਾ ਕੋਈ ਮਤਲਬ ਏ ਹੈ ਨਹੀਂ ਬਿਜਲੀ ਆਵਾ ਜਾਵਾ ਅਗਲੇ ਨੂੰ ਕੋ ਮਤਲਬ ਹੈ ਅਗਲੇ ਨੂੰ ਸੂਰਜ ਚੜਨਾ ਚਾਹੀਦਾ ਏ ਬਿਜਲੀ ਘਰ ਆਈ ਜਾਂਦੀ ਹੈ ਅਗਲੇ ਨੇ ਆਪ ਤਾਂ ਬਿਜਲੀ ਯੂਜ਼ ਕਰਦੇ ਗੁਆਂਢੀਆਂ ਨੂੰ ਵੀ ਦਿੰਦੇ ਆ ਵੇਚਦੇ ਆ ਬਿਜਲੀ ਅਗਲੇ ਇਸ ਤਰ੍ਹਾਂ ਇੱਥੇ ਹੋਰ ਵੀ ਕਈ ਬਹੁਤ ਸਾਰੇ ਵਿਕਲਪ ਹੈਗੇ ਜਿਹਦੇ ਵਿੱਚ ਲੋਕ ਬਿਜਲੀ ਦੇ ਕੱਟਾਂ ਵਿੱਚ ਜਿਹਨਾਂ ਨਾਲ ਮਤਲਬ ਉਹਨਾਂ ਨੂੰ ਬਿਜਲੀ ਦੇ ਕੱਟਾਂ ਨਾਲ ਨਜਿੱਠਣਾ ਜਾਣਦੇ ਹੈਗੇ ਜਿਹਨਾਂ ਢੰਗਾਂ ਨਾਲ